ਸਕੂਲਾਂ ਵਿੱਚ ਇੰਗਲਿਸ਼ ਮੈਥ ਪੰਜਾਬੀ ਹਿੰਦੀ ਐਸ ਐਸ ਟੀ ਸਾਇੰਸ ਮੋਰਲ ਸਾਇੰਸ ਫਿਜ਼ੀਕਲ ਐਜੂਕੇਸ਼ਨ ਫਿਜ਼ੀਕਲ ਸਪੋਰਟਸ ਡਿਵਨਟੀ ਅਜਿਹੇ ਵਿਸ਼ਾ ਪੜ੍ਹਾਏ ਜਾਂਦੇ ਹਨ ਇਹ ਬਹੁਤ ਹੀ ਅੱਛੇ ਹਨ ਬੱਚਿਆਂ ਨੂੰ ਹਰ ਤਰ੍ਹਾਂ ਦੇ ਵਿਸ਼ੇ ਨਾਲ ਜਾਣਕਾਰੀ ਹੁੰਦੀ ਹੈ ਜਾਣੂ ਹੁੰਦੇ ਹਨ ਅਧਿਆਪਕ ਤਾਂ ਬਹੁਤ ਅੱਛੇ ਹਨ ਅੱਜ ਕੱਲ੍ਹ ਬਹੁਤ ਅੱਛੇ ਅੱਛੇ ਅਧਿਆਪਕ ਹਨ ਜਿਹੜੇ ਕਿ ਇਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹਨ ਨਵੀਨਤਮ ਤਾਇਨ ਤਕਨੀਕਾਂ ਦੇ ਨਾਲ ਪੜ੍ਹਾਇਆ ਜਾ ਰਿਹਾ ਹੈ ਬੱਚਿਆਂ ਨੂੰ ਅਤੇ ਚੰਗੇ ਪੜ੍ਹੇ ਲਿਖੇ ਹਨ ਗਰੈਜੂਏਟ ਪੋਸਟ ਗਰੈਜੂਏਟ ਤੋਂ ਘੱਟ ਕੋਈ ਵੀ ਟੀਚਰ ਨਹੀਂ ਹੈ ਜਿਹੜਾ ਕਿ ਇਹਨਾਂ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਔਰ ਹਰ ਟੀਚਰ ਆਪਣੀ ਆਪਣੀ ਜਗ੍ਹਾ ਸਹੀ ਕਾਬਲੀਅਤ ਵੀ ਰੱਖਦਾ ਹੈ ਇਹਨਾਂ ਨੂੰ ਪੜ੍ਹਾਉਣ ਦੀ ਆਪਣੇ ਆਪਣੇ ਸਬਜੈਕਟ ਦੇ ਵਿੱਚ ਟੀਚਰ ਮਾਸਟਰਜ ਹਨ ਉਹਨਾਂ ਨੂੰ ਪਤਾ ਹੈ ਕਿ ਇਹ ਸਬਜੈਕਟ ਦੇ ਵਿੱਚ ਆਹ ਚੀਜ਼ਾਂ ਹਨ ਇਸ ਚੀਜ਼ ਨੂੰ ਇਸ ਪ੍ਰਕਾਰ ਦੇ ਨਾਲ ਪੜ੍ਹਾਇਆ ਜਾ ਸਕਦਾ ਹੈ ਅਤੇ ਬਹੁਤ ਹੀ ਅਵੇਕਲੇ ਤਰੀਕਿਆਂ ਦੇ ਨਾਲ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਬੱਚੇ ਜਿਹੜੇ ਨੇ ਉਹ ਵੀ ਅੱਜ ਕੱਲ੍ਹ ਚਤੁਰ ਚਲਾਕ ਹਨ ਉਹਨਾਂ ਨੂੰ ਵੀ ਸਮਝ ਆਉਂਦੀ ਹੈ ਕਿ ਕਿਹੜੀ ਚੀਜ਼ ਦਾ ਕੀ ਜਵਾਬ ਹੈ ਕਿਸ ਤਰ੍ਹਾਂ ਹੈ ਉਹ ਪ੍ਰਸ਼ਨ ਇਸ ਤਰ੍ਹਾਂ ਦੇ ਪੁੱਛਦੇ ਹਨ ਕਿ ਟੀਚਰਾਂ ਨੂੰ ਅਧਿਆਪਕਾਂ ਨੂੰ ਵੀ ਉਹ ਆਪਣੇ ਤੋਂ ਜ਼ਿਆਦਾ ਬੈਟਰ ਹੋਣ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਪਹਿਲਾਂ ਹੀ ਆਪਣੇ ਆਪ ਨੂੰ ਪਰਪੇਅਰ ਕਰਕੇ ਆਉਣਾ ਪੈਂਦਾ ਹੈ ਤਾਂ ਜੋ ਉਹ ਬੱਚਿਆਂ ਦੇ ਜਵਾਬ ਤੋਂ ਜਾਣੂ ਹੋਣ ਇਸ ਲਈ ਅਧਿਆਪਕ ਵਧੀਆ ਤਰੀਕੇ ਨਾਲ ਹੀ ਪੜ੍ਹਾਉਂਦੇ ਹਨ ਨਵੀਨਤਮ ਤਕਨੀਕਾਂ ਦੇ ਨਾਲ ਪੜ੍ਹਾਉਂਦੇ ਹਨ ਧੰਨਵਾਦ